ਇੱਕ ਯਾਤਰੀ ਬਸ ਵਿੱਚ ਸਫ਼ਰ ਕਰਨ ਦਾ ਠੀਕ ਹੀ ਤਜਰਬਾ ਰਿਹਾ ਹੈ ਜਿਸ ਦੇ ਵਿੱਚ ਡਰਾਈਵਰ ਸੀਟ ਹੁੰਦੀ ਹੈ ਸਟੋਰੇਜ ਕੈਰੀਅਰ ਉੱਪਰ ਹੁੰਦਾ ਵਿੰਡੋਜ਼ ਹੁੰਦੀਆਂ ਨੇ ਸੀਟਾਂ ਹੁੰਦੀਆਂ ਹੈ ਡੀਜ਼ਲ 'ਤੇ ਕੰਮ ਕਰਦਾ ਐ ਮਤਲਬ ਕਈ ਵਾਰੀ ਇਸ ਦੀ ਜਿਹੜੀ ਹੈ ਸਮੈਲ ਵੀ ਚੜ੍ਹਦੀ ਹੈ ਡੀਜ਼ਲ ਦੀ ਕਈ ਵਾਰੀ ਬੜਾ ਮਨ ਖ਼ਰਾਬ ਜਿਹਾ ਵੀ ਹੁੰਦਾ ਇਹਦੇ 'ਤੇ ਅਤੇ ਜਦੋਂ ਭਰੀ ਹੋਈ ਬੱਸ ਦੇ ਵਿੱਚ ਚੜ੍ਹੋ ਤਾਂ ਬੰਦੇ ਨੂੰ ਬੜੀ ਖਿਝ ਚੜ੍ਹਦੀ ਹੈ ਕਿ ਬੰਦਾ ਕਹਿੰਦਾ ਕਿ ਮਤਲਬ ਆਪਾਂ ਕਿੱਥੇ ਆ ਗਏ ਹਾਂ ਅਤੇ ਕਈ ਵਾਰੀ ਇੱਕ ਜੱਥੇ ਨਾਲ ਵੀ ਜਦੋਂ ਯਾਤਰਾ ਕੀਤੀ ਹੈ ਤਾਂ ਉਦੋਂ ਬੜਾ ਵਧੀਆ ਰਿਹਾ ਹੈ ਜੱਥੇ ਦੇ ਨਾਲ ਇੱਕ ਜਦੋਂ ਬਸ ਯਾਤਰਾ ਕੀਤੀ ਅਤੇ ਰਸਤੇ ਦੇ ਵਿੱਚ ਆਪਣਾ ਸ਼ਬਦ ਪੜ੍ਹਦੇ ਹੋਏ ਅਤੇ ਪਾਠ ਕਰਦੇ ਹੋਏ ਜਦੋਂ ਗਏ ਤਾਂ ਬੜਾ ਵਧੀਆ ਰਿਹਾ ਅਤੇ ਜਿਹੜੀ ਇਹ ਬਸ ਦੀ ਯਾਤਰਾ ਸੀਗੀ ਉਹ ਬੜੀ ਯਾਦਗਾਰ ਰਹਿ ਗਈ ਲੋਕ ਆਪਣਾ ਖਾਣ ਪੀਣ ਦਾ ਸਮਾਨ ਲੰਗਰ ਦੇ ਰੂਪ ਦੇ ਵਿੱਚ ਲੈ ਕੇ ਆਏ ਹੋਏ ਸੀਗੇ ਅਤੇ ਉਹ ਵਿੱਚ ਹੀ ਉੱਥੇ ਸਾਰਾ ਸਮਾਨ ਅ ਖਾਣ ਪੀਣ ਲਈ ਵੀ ਦਿੱਤਾ ਉਨ੍ਹਾਂ ਨੇ ਉਸ ਤੋਂ ਇਲਾਵਾ ਉਨ੍ਹਾਂ ਨੇ ਅ ਆਪਣਾ ਹਾਰਮੋਨੀਅਮ ਤਬਲਾ ਢੋਲਕੀ ਛੈਨੇ ਸਭ ਕੁਛ ਲੈ ਕੇ ਗਏ ਹੋਏ ਸੀ ਰਸਤੇ 'ਚ ਕੀਰਤਨ ਕਰਦੇ ਪਤਾ ਹੀ ਨਾ ਲੱਗਿਆ ਕਿ ਕਿੰਨਾ ਅ ਸਮਾਂ ਜਿਹੜਾ ਸੀ ਉਹ ਇਸ ਤਰ੍ਹਾਂ ਲੰਘ ਗਿਆ ਅਤੇ ਬੜਾ ਚੰਗਾ ਰਿਹਾ ਅਤੇ ਇੱਕ ਦੋ ਵਾਰੀ ਜਦੋਂ ਹੈ ਉਹਦੇ 'ਚ ਯਾਤਰਾ ਕੀਤੀ ਜਿਹੜੀ ਵੋਲਵੋ ਬੱਸ ਵਿੱਚ ਤਾਂ ਉਹ ਤਾਂ ਬਹੁਤ ਹੀ ਆਰਾਮਦਾਇਕ ਸਫ਼ਰ ਸੀਗਾ ਅਤੇ ਬਹੁਤ ਜ਼ਿਆਦਾ ਚੰਗਾ ਲੱਗਿਆ ਕਿਉਂਕਿ ਹਰ ਇੱਕ ਚੀਜ਼ ਸੀਟਾਂ ਹਰ ਚੀਜ਼ ਕੋਈ ਆਵਾਜ਼ ਨਹੀਂ ਬੱਸਾਂ ਦੀ ਖੜ ਖੜ ਵਾਲੀ ਆਵਾਜ਼ ਨਹੀਂ ਕੁਛ ਵੀ ਨਹੀਂ ਇੰਝ ਲੱਗਿਆ ਕਿ ਆਪਣੀ ਕਾਰ ਦੇ ਵਿੱਚ ਆਪਣੇ ਘਰ ਆਏ ਹਾਂ ਤੇ ਉਹ ਬਹੁਤ ਚੰਗਾ ਲੱਗਿਆ ਅਤੇ ਅੱਜ ਦੇ ਜ਼ਮਾਨੇ ਦੇ ਵਿੱਚ ਪੁਰਾਣੀਆਂ ਬੱਸਾਂ ਦੇ ਮੁਕਾਬਲੇ 'ਚ ਬਹੁਤ ਵਧੀਆ ਯਾਤਰਾ ਹੈ ਬੰਦੇ ਨੂੰ ਕੋਈ ਥਕਾਵਟ ਨਹੀਂ ਹੁੰਦੀ ਕੁਛ ਨਹੀਓ ਪਤਾ ਲੱਗਦਾ